ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜਿਵੇਂ ਤੇ ਤੁਸ ਤਰਨ ਤਾਰਨ ਤੋਂ ਹੀ ਹਾਂਜੀ ਬੋਲ ਰਹੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤਰਨ ਤਾਰਨ ਮਤਲਬ ਕਿ ਅੰਮ੍ਰਿਤਸਰ ਜਾ ਰਹੀ ਹੈ ਫਿਰੋਜ਼ਪੁਰ ਜਾ ਰਹੀ ਆ ਜਲੰਧਰ ਜਾ ਰਹੀ ਆ ਹਰੀਕੇ ਜਾ ਰਹੀ ਆ ਖੇਮਕਰਨ ਜਾ ਰਹੀ ਆ ਹਾਂਜੀ ਪੰਜਾਬ ਦੇ ਅਲੱਗ ਅਲੱਗ ਜਿਹੜੇ ਸ਼ਹਿਰ ਆ ਉਹਨਾਂ ਦੇ ਹਰੇਕ ਹੀ ਸ਼ਹਿਰ ਦੇ ਵਿੱਚ ਟਰੇਨ ਦਾ ਨੈਟਵਰਕ ਹੈਗਾ ਜੀ ਤੁਸੀਂ ਜਦੋਂ ਮਰਜ਼ੀ ਘੁੰਮਣ ਆ ਸਕਦੇ ਜੇ ਜਦੋਂ ਮਰਜੀ ਟਿਕਟ ਕਰਵਾ ਸਕਦੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਜੇ ਸਾਡੇ ਕੋਲ ਜਦੋਂ ਮਰਜ਼ੀ ਘੁੰਮ ਸਕਦੇ ਜੇ ਹਰੇਕ ਜਗ੍ਹਾ 'ਤੇ ਟਰੇਨ ਜਿਹੜੀ ਉਹ ਜਾ ਰਹੀ ਹੈ ਸਹੀ ਠੀਕ ਹਾਂਜੀ ਜੀ ਅੰਮ੍ਰਿਤਸਰ ਦੋ ਵਜੇ ਜਾ ਰਹੀ ਹੈ ਜਲੰਧਰ ਚਾਰ ਵਜੇ ਜਾ ਰਹੀ ਆ ਅਤੇ ਪਠਾਨਕੋਟ ਪੰਜ ਵਜੇ ਜਾ ਰਹੀ ਹੈ ਇੱਦਾਂ ਕਿ ਸਾਰਾ ਟਾਈਮਿੰਗ ਫਿਕਸ ਕੀਤਾ ਹੋਇਆ ਟਰੇਨ ਦਾ ਹਰੇਕ ਟਾ ਟ੍ਰੇਨ ਜਿਹੜੀ ਆ ਸਮੇਂ ਸਮੇਂ ਸਿਰ ਜਿਹੜੀ ਜਾ ਰਹੀ ਹੈ ਸਹੀ ਸਹੀ ਟਾਈਮ 'ਤੇ ਜਾ ਰਹੀ ਹੈ ਜੀ ਨਹੀਂ ਜੀ ਸੀਟ ਵੀ ਬਹੁਤ ਵਧੀਆ ਨੇ ਨਿਊ ਸ਼ੀਟਸ ਨੇ ਹਰੇਕ ਚੀਜ਼ ਬਹੁਤ ਹੀ ਵਧੀਆ ਵਾ ਟਰੇਨ ਦੇ ਵਿੱਚ ਤੁਹਾਨੂੰ ਕਿਸੇ ਵੀ ਗੱਲ ਦੀ ਕੋਈ ਦਿੱਕਤ ਨਹੀਂ ਹੋਏਗੀ ਜੀ ਹਰੇਕ ਚੀਜ਼ ਜਿਹੜੀ ਆ ਜੀ

ਤੁਸੀਂ ਡੇਟ ਦੱਸ ਦਿਓ ਜੀ ਜਦੋਂ ਵੀ ਟਿਕਟ ਤੁਸੀਂ ਬੁੱਕ ਕਰਵਾਉਣੀ ਹੋਈ ਤੁਹਾਨੂੰ ਟਿਕਟ ਜਿਹੜੀ ਆ ਟਮੇਂ ਸਮੇਂ ਸਿਰ ਮਿਲ ਜਾਏਗੀ ਸ਼ੀਟ ਵੀ ਤੁਹਾਨੂੰ ਵਧੀਆ ਦੇਗੀ ਸਾ ਹਰੇਕ ਚੀਜ਼ ਜਿਹੜੀ ਆ ਤੁਹਾਨੂੰ ਬਹੁਤ ਹੀ ਵਧੀਆ ਮਿਲੇਗੀ ਟ੍ਰੇਨ ਦੇ ਵਿੱਚ ਖਾਣਾ ਪੀਣਾ ਵੀ ਬਾਥਰੂਮ ਵਗੈਰਾ ਵੀ ਸਾਰਾ ਕੁਛ ਜਿਹੜਾ ਵੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ ਜੀ ਟਰੇਨ ਦੇ ਵਿੱਚ ਹਾਂਜੀ ਜੀ ਨਹੀਂ ਜੀ ਤੁਹਾਨੂੰ ਤਰਨ ਤਾਰਨ ਤੋਂ ਵੀ ਟਰੇਨ ਜਿਹੜੀ ਆ ਸਿੱਧੀ ਹਰਿਆਣੇ ਦੀ ਮਿਲ ਜਾਏਗੀ ਜੀ ਥੈਂਕ ਯੂ ਜੀ